ਹੈਲੋ ਮੈਂ ਆਪਣੇ ਨਵਜੰਮੇ ਬੱਚੇ ਦੇ ਜਨਮ ਰਜਿਸਟਰੇਸ਼ਨ ਬਾਰੇ ਗੱਲਬਾਤ ਕਰਨਾ ਚਾਹੁੰਦਾ ਹਾਂ ਮੈਂ ਹਾਲ ਹੀ ਵਿੱਚ ਆਨਲਾਈਨ ਰਜਿਸਟਰੇਸ਼ਨ ਕਰਵਾਈ ਸੀ ਉਹ ਸਭ ਦਾ ਲਈ ਮਾਫੀ ਮੈਨੂੰ ਮੁਆਫੀ ਚੈ ਚਾਹੀਦੀ ਹੈ ਪਰ ਮੈਂ ਆਪਣੇ ਇਹ ਰਜਿਸਟਰੇਸ਼ਨ ਰੱਦ ਕਰਨ ਦੀ ਜ਼ਰੂਰਤ ਹੈ ਕਾਰਨ ਇਹ ਹੈ ਕਿ ਮੈਂ ਕੁਝ ਗਲਤ ਜਾਣਕਾਰੀ ਦਿੱਤੀ ਸੀ ਰੱਦ ਕਰਨ ਦੀ ਪ੍ਰਕਿਰਿਆ ਕਿਰਪਾ ਕਰਕੇ ਮੈਨੂੰ ਰਜਿਸਟ੍ਰੇਸ਼ਨ ਰੱਦ ਕਰਨ ਦੇ ਪ੍ਰਕਿਰਿਆ ਬਾਰੇ ਦੱਸੋ ਮੈਂ ਆਪਣਾ ਅਰਜੀ ਸੰਦਰਭ ਨੰਬਰ ਦੇ ਰਿਹਾ ਹਾਂ ਮੇਰੀ ਅਰਜ਼ੀ ਸੰਦਰ ਨ ਸੰਦਰਭ ਨੰਬਰ ਹੈ ਅਰਜ਼ੀ ਸੰਦਰਭ ਨੰਬਰ ਕਿਰਪਾ ਕਰਕੇ ਮੈਨੂੰ ਆਪਣੀ ਅਗਲੀ ਕਾਰਵਾਈ ਬਾਰੇ ਦੱਸੋ